ਪੈਸੇ ਅਸੀਂ ਗੱਲ ਕਰੀਏ ਤਾਂ ਅਸੀਂ ਪੈਸੇ ਐੱਫ ਡੀ ਕਰਵਾ ਕੇ ਜਾਂ ਮਿਊਚੁਅਲ ਫੰਡ ਵਿੱਚ ਅਸੀਂ ਆਪਣੇ ਪੈਸੇ ਜਮ੍ਹਾਂ ਕਰ ਸਕਦੇ ਹਾਂ ਮੈਂ ਆਪਣੇ ਪੈਸੇ ਬਚਾਉਣ ਲਈ ਐੱਫ ਡੀ ਕਰਵਾਈ ਹੋਈ ਹੈ ਜਿਸ ਵਿੱਚ ਮੈਂ ਆਪਣੇ ਪੈਸੇ ਜਮ੍ਹਾਂ ਕਰਵਾਉਂਦੀ ਹਾਂ ਅਤੇ ਉਸਨੂੰ ਮੈਂ ਲੋੜ ਪਈ 'ਤੇ ਉਸ ਐੱਫ ਡੀ ਨੂੰ ਤੁੜਵਾ ਕੇ ਆਪਣੇ ਲਈ ਖਰਚ ਸਕਦੀ ਹਾਂ